ਜੇ ਖੇਡਾਂ ਦੀ ਗੱਲ ਕਰੀਏ ਤਾਂ ਜੋ ਪੰਜਾਬ 'ਚ ਪ੍ਰਚੱਲਿਤ ਖੇਡਾਂ ਨੇ ਉਹੀ ਸਾਡੇ ਇੱਥੇ ਸ਼ਹਿਰ ਵਿੱਚ ਖੇਤਰ ਵਿੱਚ ਖੇਡੀ ਜਾਂਦੀਆਂ ਨੇ ਕੋਈ ਜ਼ਿਆਦਾ ਫਰਕ ਨਹੀਂ ਹੈ ਅਤੇ ਬੱਚੇ ਉਹੀ ਜਿਹੇ ਖੇਡਾਂ ਖੇਡਣੀਆਂ ਪਸੰਦ ਕਰਦੇ ਆ ਜੋ ਆਮ ਹੈਗਾ ਨਾ ਸਾਰੇ ਪੰਜਾਬ 'ਚ ਪਰ ਅੱਜ ਕੱਲ੍ਹ ਜਿਵੇਂ ਨਾ ਮੋਬਾਈਲ ਦਾ ਜ਼ਿਆਦਾ ਦੌਰ ਆ ਤਾਂ ਉਸ ਤਰ੍ਹਾਂ ਦੀ ਖੇਡਾਂ ਜੋ ਅਸੀਂ ਆਪਣੇ ਬਚਪਨ 'ਚ ਖੇਡਦੇ ਸੀ ਉਸ ਤਰ੍ਹਾਂ ਦੀ ਬੱਚੇ ਅੱਜ ਕੱਲ੍ਹ ਨਹੀਂ ਖੇਡਦੇ ਹੈਗੇ ਅਤੇ ਅੱਜ ਕੱਲ੍ਹ ਬੱਚੇ ਜ਼ਿਆਦਾਤਰ ਜਿਹੜੀਆਂ ਗੇਮਸ ਨੇ ਜਿਵੇਂ ਕਹਿ ਲਉ ਕ੍ਰਿਕਟ ਹੋਇਆ ਬੈਡਮਿੰਟਨ ਹੋਇਆ ਜਾਂ ਬੌਕਸਿੰਗ ਵਗੈਰਾ ਇਸ ਤਰ੍ਹਾਂ ਦੇ ਸਕੇਟਿੰਗ ਦੇ ਵੀ ਸ਼ੌਕੀਨ ਨੇ ਤਾਂ ਬੱਚੇ ਥੋੜ੍ਹੀ ਇਸ ਤਰ੍ਹਾਂ ਦੀ ਗੇਮਜ਼ ਦੇ ਵਿੱਚ ਜ਼ਿਆਦਾ ਇੰਟਰਸਟਿਡ ਨੇ ਜਿਹਦੇ ਵਿੱਚ ਨਾ ਉਹ ਅੱਗੇ ਸਕੂਲ ਲੈਵਲ 'ਤੇ ਖੇਡ ਸਕਣ ਜਾਂ ਫਿਰ ਕਿਸੇ ਡਿਸਟ੍ਰਿਕ ਲੈਵਲ 'ਤੇ ਨੈਸ਼ਨਲ ਲੈਵਲ 'ਤੇ ਖੇਡ ਸਕਣ ਅਤੇ ਜਿਹੜੀਆਂ ਰਵਾਇਤੀ ਖੇਡਾਂ ਨੇ ਉਹ ਤਾਂ ਮੈਂ ਨਹੀਂ ਦੇਖਦਾ ਕਿ ਅੱਜ ਕੱਲ੍ਹ ਬੱਚੇ ਖੇਡ ਰਹੇ ਨੇ ਜਿਵੇਂ ਸਾਡੇ ਟਾਈਮ ਕੋਈ ਗੁੱਲੀ ਡੰਡਾ ਖੇਡਦਾ ਹੁੰਦਾ ਸੀਗਾ ਹੈ ਨਾ ਲੁੱਕਣ ਮਿੱਟੀ ਖੇਡ ਲਈ ਜਾਂ ਪੀਚੋ ਖੇਡ ਲਈ ਉਹ ਮੈਂ ਹੁਣ ਨਹੀਂ ਦੇਖਿਆ ਬੱਚਿਆਂ ਕਿਸੇ ਨੂੰ ਖੇਡਦੇ ਹੋਏ ਅਤੇ ਕਾਫੀ ਅੰਤਰ ਆਇਆ ਜੋ ਸਾਡੇ ਸਮੇਂ 'ਤੇ ਹੁਣ ਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਤਕਰੀਬਨ ਸਾਰੇ ਪੰਜਾਬ 'ਚ ਹੀ ਇਸ ਤਰ੍ਹਾਂ ਦਾ ਹੁਣ ਮ ਮਾਹੌਲ ਹੋਵੇਗਾ ਕਿ ਬੱਚੇ ਜਿਹੜੀਆਂ ਰਵਾਇਤੀ ਖੇਡਾਂ ਨੂੰ ਛੱਡ ਕੇ ਜਿਹੜੀਆਂ ਹੋਰ ਖੇਡਾਂ ਨੇ ਉਹਨਾਂ ਵੱਲ ਜ਼ਿਆਦਾ ਧਿਆਨ ਦਿੰਦੇ ਨੇ ਜਾਂ ਫਿਰ ਵੀਡੀਓ ਗੇਮ ਖੇਡਦੇ ਨੇ ਅਤੇ ਇਸ ਕਰਕੇ ਮੋਰ ਓਰ ਲੈਸ ਇਹੀ ਕਿਹਾ ਵੀ ਉਹੀ ਖੇਡਾਂ ਖੇਡੀਆਂ ਜਾਂਦੀਆਂ ਨੇ ਜੋ ਬਾਕੀ ਪੰਜਾਬ 'ਚ ਕਿਸ ਤਰ੍ਹਾਂ ਦੀ ਕੋਈ ਖਾਸ ਉਰੇ ਖੇਡ ਤਾਂ ਨਹੀਂ ਖੇਡੀ ਜਾਂਦੀ ਹੈਗੀ